ਸਾਡੇ ਸਕੂਲ ਦੇ ਵਿੱਚ ਚਿੱਤਰਕਾਰੀ ਦੇ ਅਲੱਗ ਤੋਂ ਅਧਿਆਪਕ ਸਨ ਜਿਨ ਜਿਨ੍ਹਾਂ ਨੇ ਸ ਜਿਹੜੇ ਸਾਨੂੰ ਆਪਣੀ ਕਲਾਸ ਦੇ ਵਿੱਚ ਬਹੁਤ ਹੀ ਵਧੀਆ ਢੰਗ ਨਾਲ ਸਿਖਾਉਂਦੇ ਸਨ ਕ ਉਹਨਾਂ ਨੇ ਦੱਸਿਆ ਸੀ ਕਿ ਚਿੱਤਰਕਾਰੀ ਇੱਕ ਅਜਿਹਾ ਅਜਿਹੀ ਲੈਂਗੁਏਜ ਹੈ ਜਿਹਦੇ ਨਾਲ ਅਸੀਂ ਅਸੀਂ ਆਪਣੀਆਂ ਭਾਵਨਾਵਾਂ ਨੂੰ ਪ੍ਰਗਟ ਕਰ ਸਕਦੇ ਹਨ ਬਿਨਾ ਬੋ ਬਿਨਾ ਬੋਲੇ ਪ੍ਰਗਟ ਕਰ ਸਕਦੇ ਹਾਂ ਚਿੱਤਰਕਾਰੀ ਦੇ ਵਿੱਚ ਚਿੱਤਰਕਾਰੀ ਇੱਕ ਅਜਿਹੀ ਅਜਿਹੀ ਚੀਜ਼ ਹੈ ਜਿਸ ਨਾਲ ਜਿਸ ਨਾਲ ਕਿਸੇ ਵੀ ਬੰਦੇ ਨੂੰ ਮੋਹਿਤ ਕੀਤਾ ਜਾ ਸਕਦਾ ਹੈ ਚਿੱਤਰਕਾਰੀ ਚਿੱਤਰਕਾਰੀ ਦੀ ਕਲਾਸਾਂ ਦੇ ਵਿੱਚ ਮੈਨੂੰ ਬਹੁਤ ਹੀ ਵਧੀਆ ਅਨੰਦ ਮਿਲਿਆ ਜਿਵੇਂ ਕਿ ਚਿੱਤਰਕਾਰੀ ਦੀ ਕਲਾਸਾਂ ਦੇ ਵਿੱਚ ਮੈਨੂੰ ਇਹ ਸਿੱਖ ਇਹ ਸਿੱਖਣ ਦੀ ਜਾਣਕਾਰੀ ਮਿਲੀ ਕਿ ਕਿਵੇਂ ਬਿਨਾ ਬੋਲੇ ਮੈਂ ਆਪਣੀਆਂ ਭਾਵਨਾਵਾਂ ਆਪਣੇ ਵਿਚਾਰਾਂ ਨੂੰ ਪ੍ਰਗਟ ਕਰ ਸਕਦਾ ਹਾਂ ਚਿੱਤਰਕਾਰੀ ਇੱਕ ਅਜਿਹੀ ਭਾਸ਼ਾ ਹੈ ਜਿਹੜੀ ਸਾਨੂੰ ਜਿਹੜੀ ਸਾਨੂੰ ਸਿਖਾਉਂਦੀ ਹੈ ਕਿ ਕਿਵੇਂ ਕਿਵੇਂ ਅਸੀਂ ਇੱਕ ਰੰਗ ਜਾਂ ਬਹੁਤੇ ਰੰਗਾਂ ਨਾਲ ਕਿਸੇ ਵੀ ਚੀਜ਼ ਨੂੰ ਸੁੰਦਰ ਬਣਾ ਬਣਾ ਸਕਦੇ ਹਾਂ ਚਿੱਤਰ